ਇਹ ਗੱਲ ਸੱਚ ਹੈ ਕਿ ਡਾਂਸ ਸਾਡੀ ਜ਼ਿੰਦਗੀ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ ਇਸਨੂੰ ਕਰਨ ਨਾਲ ਅਸੀਂ ਆਪਦਾ ਸਟਰੈਸ ਲੈਵਲ ਘੱਟ ਕਰਦੇ ਹਾਂ ਅਤੇ ਸਾਡੇ 'ਚ ਬਹੁਤ ਪੋਜ਼ੀਟਿਵ ਚੇਂਜਸ ਆਉਂਦੇ ਹਨ ਜਿਵੇਂ ਸਾਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਸਾਨੂੰ ਐਨਰਜੀ ਮਿਲਦੀ ਹੈ ਪਹਿਲਾਂ ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਅਤੇ ਜਦੋਂ ਮੈਂ ਪਹਿਲਾਂ ਪਹਿਲਾਂ ਕਰਦੀ ਹੁੰਦੀ ਸੀ ਤਾਂ ਮੈਂ ਥੱਕ ਜਾਂਦੀ ਸੀ ਪਰ ਹੁਣ ਐਵੇਂ ਦਾ ਕੁਝ ਨਹੀਂ ਹੈ ਹੁਣ ਮੈਨੂੰ ਡਾਂਸ ਕਰਕੇ ਬਹੁਤ ਸਕੂਨ ਮਿਲਦਾ ਹੈ ਅਤੇ ਮੇਰੇ 'ਚ ਨਵੀਂ ਐਨਰਜੀ ਆਉਂਦੀ ਹੈ ਅਤੇ ਮੈਨੂੰ ਜ਼ਿਆਦਾ ਵਧੀਆ ਲੱਗਦਾ ਹੈ ਅਤੇ ਅੱਜ ਕੱਲ੍ਹ ਮੈਂ ਨਵੇਂ ਨਵੇਂ ਤਰੀਕੇ ਦੇ ਡਾਂਸ ਸਿੱਖ ਰਹੀ ਹਾਂ ਜਿਸ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਪਹਿਲਾਂ ਮੈਨੂੰ ਜਦੋਂ ਵੀ ਮੈਨੂੰ ਕੋਈ ਮੁਕਾਬਲੇ ਦੇ ਵਿੱਚ ਪਾਰਟੀਸਪੇਟ ਕਰਨ ਲਈ ਕਹਿੰਦਾ ਸੀ ਤਾਂ ਮੈਨੂੰ ਡਰ ਲੱਗਦਾ ਸੀ ਪਰ ਡਾਂਸ ਕਰਨ ਨਾਲ ਹੁਣ ਮੇਰੇ ਵਿੱਚ ਕੋਨਫੀਡੈਂਸ ਆਇਆ ਹੈ ਜਿਸ ਕਰਕੇ ਮੈਂ ਕੁਛ ਵੀ ਕਰ ਸਕਦੀ ਹਾਂ ਅਤੇ ਮੈਂ ਬਹੁਤ ਸਾਰੇ ਡਾਂਸ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੀ ਹਾਂ ਵੱਧ ਚੜ੍ਹ ਕੇ ਹਿੱਸਾ ਲੈਂਦੀ ਹਾਂ ਅਤੇ ਮੈਨੂੰ ਡਾਂਸ ਕਰਕੇ ਬਹੁਤ ਹੀ ਸਨਮਾਨ ਵੀ ਮਿਲੇ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਹੁਣ ਅੱਗੇ ਹਾਈ ਲੈਵਲ 'ਤੇ ਇਸਨੂੰ ਡਾਂਸ ਵਿੱਚ ਹਿੱਸਾ ਲਵਾਂ